ਜਦੋਂ ਅਸੀਂ ਵਿਆਹ ਵਿੱਚ ਜਾਂਦੇ ਹਾਂ ਪਹਿਲਾਂ ਅਖੰਡ ਪਾਠ ਰੱਖਿਆ ਹੁੰਦਾ ਹੈ ਅਸੀਂ ਮੱਥਾ ਟੇਕਦੇ ਹਾਂ ਅਤੇ ਅਖੰਡ ਪਾਠ ਗੁਰਬਾਣੀ ਸੁਣਦੇ ਹਾਂ ਉਸਤੋਂ ਬਾਅਦ ਕੀਰਤਨ ਹੁੰਦਾ ਹੈ ਕੀਰਤਨ ਤੋਂ ਬਾਅਦ ਭੋਗ ਪੈਂਦਾ ਹੈ ਅਤੇ ਉਸ ਤੋਂ ਬਾਅਦ ਅਸੀਂ ਖਾਣਾ ਖਾਂਦੇ ਹਾਂ ਖਾਣੇ ਵਿੱਚ ਬਹੁਤ ਵਧੀਆ ਵਧੀਆ ਡਿੱਸ਼ਾਂ ਬਣੀਆਂ ਹੁੰਦੀਆ ਹਨ ਜਿਵੇਂ ਕਿ ਪਕੌੜੇ ਵਗੈਰਾ ਵੀ ਪ੍ਰਸ਼ਾਦ ਰੋਟੀਆਂ ਸਬਜ਼ੀਆਂ ਬੜੀਆਂ ਅੱਛੀਆਂ ਲੱਗਦੀਆਂ ਹਨ ਬਹੁਤ ਇੰਨਜੋਆਏ ਬਹੁਤ ਵਧੀਆ ਅਸੀਂ ਉੱਥੇ ਘੁੰਮਦੇ ਫਿਰਦੇ ਅਤੇ ਮਸਤੀ ਮਾਰਦੇ ਹਨ ਅਤੇ ਉਸ ਤੋਂ ਬਾਅਦ ਜੋ ਵੀ ਵਿਆਹ ਵਿੱਚ ਆਪਾਂ ਨੇ ਦੇਣ ਲੈਣ ਕਰਨਾ ਹੁੰਦਾ ਹੈ ਉਹ ਵੀ ਕਰਦੇ ਹਨ ਫਿਰ ਦੂਜਾ ਦਿਨ ਬਰਾਤ ਵਾਲੇ ਦਿਨ ਅਸੀਂ ਘੋੜੀਆਂ ਗਾਉਂਦੇ ਹਾਂ ਆਪਣੇ ਵੀਰ ਦੀ ਬਰਾਤ ਚੜ੍ਹਾਉਂਦੀਆਂ ਹਨ ਭੈਣਾਂ ਉਸ ਤੋਂ ਬਾਅਦ ਅਸੀਂ ਅਨੰਦ ਕਾਰਜਾਂ ਦੀ ਰਸਮ ਕਰਦੇ ਹਾਂ ਅਨੰਦ ਕਾਰਜਾਂ ਤੋਂ ਬਾਅਦ ਅਸੀਂ ਫਿਰ ਆਪਣਾ ਡੋਲ਼ੀ ਵਿਦਾ ਹੁੰਦੀ ਹੈ ਡੋਲ਼ੀ ਤੋਂ ਬਾਅਦ ਆਪਣੇ ਘਰ ਆ ਕੇ ਵੀ ਅਸੀਂ ਗਾਣੇ ਗਾਉਂਦੇ ਹਾਂ ਅਤੇ ਸਾਨੂੰ ਗਾਣੇ ਜਿਵੇਂ ਕਿ ਬਹੁਤ ਜ਼ਿਆਦਾ ਗਿੱਧਾ ਪਸੰਦ ਹੈ ਅਤੇ ਅਸੀਂ ਗਿੱਧਾ ਜਿਵੇਂ ਕਿ ਇਹ ਗੁਰਦਾਸ ਮਾਨ ਜੀ ਦੇ ਗਾਣੇ 'ਤੇ ਅਤੇ ਆਪਣਾ ਮੂਸੇ ਵਾਲ ਸਿੱਧੂ ਮੂਸੇਵਾਲ ਜੀ ਦੇ ਗਾਣੇ 'ਤੇ ਬਹੁਤ ਅਸੀਂ ਆਪਣਾ ਇੰਨਜੋਆਏ ਕਰਦੇ ਹਾਂ ਗਾਣਾ ਗਾਉਂਦੇ ਹੈ ਨੱਚਦੇ ਹੈ ਟੱਪਦੇ ਹਾਂ ਬਹੁਤ ਖੁਸ਼ੀਆਂ ਮਨਾਉਂਦੇ ਹਾਂ